ਇਤਿਹਾਸ ਦੇ ਦੌਰਾਨ ਸਾਡੇ ਖੇਤਰ ਦੇ ਵਿੱਚ ਬਹੁਤ ਵੱਖੋ ਵੱਖਰੇ ਭਾਈਚਾਰਿਆਂ ਨੇ ਆਪਸੀ ਤਾਲਮੇਲ ਦਿਖਾਇਆ ਜਿਵੇਂ ਕਿ ਇਤਿਹਾਸ ਦੀ ਤਰ੍ਹਾਂ ਸਾਡੇ ਖੇਤਰ ਦੇ ਲੋਕਾਂ ਨੇ ਆਪਣੇ ਵਿੱਚ ਭਾਈਚਾਰਾ ਸਥਾਪਿਤ ਕਰਨ ਦੇ ਲਈ ਕਈ ਤਰੀਕੇ ਵਰਤੇ ਪੰਜਾਬ ਦੇ ਲੋਕਾਂ ਦੀ ਸੰਸਕ੍ਰਿਤਿਕ ਵਿਰਾਸਤ ਭਾਸ਼ਾ ਰਿਵਾਇਤਾਂ ਨੇ ਉਹਨਾਂ ਨੂੰ ਜੋੜਨ ਵਿੱਚ ਬਹੁਤ ਸਹਾਇਤਾ ਕੀਤੀ ਜਿਸ ਨਾਲ ਉਹਨਾਂ ਦੇ ਵਿੱਚ ਮਿਲਵਰਤਣ ਅਤੇ ਤਾਲਮੇਲ ਦੀ ਭਾਵਨਾ ਪੈਦਾ ਹੋਈ ਅਤੇ ਵੇਖਣ ਨੂੰ ਵੀ ਮਿਲੀ ਇਸ ਦੇ ਵਿੱਚ ਸਾਂਝੇ ਰਿਵਾਜ਼ ਅਤੇ ਸੰਸਕਾਰ ਮਤਲਬ ਪੰਜਾਬ ਦੇ ਲੋਕਾਂ ਨੇ ਆਪਣੇ ਧਰਮ ਦੇ ਰਿਵਾਜ਼ਾਂ ਅਤੇ ਰੀਤੀਆਂ ਨੂੰ ਸਮਾਨਤਾਵਾਂ ਦੁਆਰਾ ਭਾਈਚਾਰਾ ਬਣਾਇਆ ਹਰ ਸਮੁਦਾਇ ਨੇ ਆਪਸ ਵਿੱਚ ਖੁਸ਼ੀ ਦੁੱਖ ਸਾਂਝੇ ਕੀਤੇ ਜਿਸ ਦੇ ਨਾਲ ਮਿਲਵਰਤਨ ਦੀ ਭਾਵਨਾ ਵੀ ਪੈਦਾ ਹੋਈ ਸਮੁਦਾਇਕ ਮੇਲੇ ਅਤੇ ਤਿਉਹਾਰ ਹੋਣ ਲੱਗ ਗਏ ਬਸੰਤ ਲੋਹੜੀ ਹੋਲੀ ਵਰਗੇ ਤਿਉਹਾਰਾਂ ਨੇ ਲੋਕਾਂ ਨੂੰ ਇਕੱਠੇ ਆਉਣ ਅਤੇ ਆਪਣੀਆਂ ਸਮੁੰਦਰੀਆਂ ਨੂੰ ਮਨਾਉਣ ਦਾ ਮੌਕਾ ਦਿੱਤਾ ਜਿਸ ਨਾਲ ਖੁਸ਼ੀਆਂ ਵਿੱਚ ਵੀ ਵਾਧਾ ਹੋਇਆ ਸਿਆਸੀ ਏਕਤਾ ਆਜ਼ਾਦੀ ਦੇ ਲਹਿਰ ਅਤੇ ਖਿਲਾਫ਼ ਮੋਚਿਆਂ ਦੌਰਾਨ ਸਾਰਿਆਂ ਧਰਮਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਆਪਣੀਆਂ ਮੰਗਾਂ ਰੱਖੀਆਂ ਜਿਸ ਨਾਲ ਭਾਈਚਾਰੇ ਦਾ ਭਾਵ ਬਣਿਆ ਰਿਹਾ ਅਤੇ ਤਾਲਮੇਲ ਵੀ ਪੈਦਾ ਹੋਇਆ ਸੰਸਕ੍ਰਿਤ ਆਦਾਨ ਪ੍ਰਦਾਨ ਹੋਣ ਲੱਗ ਗਏ ਲੋਕ ਗਾਣੇ ਨਾਚ ਕਹਾਣੀਆਂ ਸਾਂਝੀਆਂ ਕਰਕੇ ਆਪਸ ਵਿੱਚ ਗਹਿਰੇ ਸੰਬੰਧ ਬਣ ਬਣਨ ਲੱਗ ਪਏ ਸਿੱਖ ਗੁਰੂਆਂ ਦੀ ਸਿੱਖਿਆ ਸਿੱਖ ਗੁਰੂਆਂ ਨੇ ਪ੍ਰਸਿੱਧ ਰਾਏ ਦੇ ਅਨੁਸਾਰ ਸਾਰੀ ਮਨੁੱਖਤਾ ਦੇ ਬਾਰੇ ਸੋਚਣਾ ਅਤੇ ਸਮਾਨਤਾਵਾਂ ਦਾ ਭਾਵ ਸਿਖਾਇਆ ਜੋ ਲੋਕਾਂ ਵਿੱਚ ਭਾਈਚਾਰਾ ਪੈਦਾ ਕੀਤਾ ਗਿਆ ਇਹਨਾਂ ਕਾਰਨਾਂ ਨਾਲ ਪੰਜਾਬ ਦੇ ਲੋਕਾਂ ਨੇ ਆਪਣੇ ਵਿਚਕਾਰ ਭਾਈਚਾਰਾ ਸਥਾਪਿਤ ਕੀਤਾ ਜੋ ਕਿ ਅੱਜ ਵੀ ਵਿਰਾਸਤ ਵਜੋਂ ਜਿਉਂਦਾ ਹੈ ਇਸ ਤੋਂ ਬਿਨਾਂ ਹੋਰ ਗੱਲ ਕਰੀਏ ਤਾਂ ਸਾਡੇ ਖੇਤਰ ਦੇ ਲੋਕਾਂ ਨੇ ਭਾਈਚਾਰਾ ਸਥਾਪਿਤ ਕਰਨ ਲਈ ਹੋਰ ਵੀ ਕਈ ਮਹੱਤਵਪੂਰਨ ਤਰੀਕੇ ਅਪਣਾਏ ਜਿਵੇਂ ਕਿ ਸਮਾਜਿਕ ਸੰਸਥਾਵਾਂ ਲੋਕਾਂ ਨੇ ਗਾਇਕਾਂ ਦਾਸੀਆਂ ਅਤੇ ਫਕੀਰਾਂ ਨੂੰ ਆਪਣੀ ਸੰਸਕ੍ਰਿਤ ਜੀਵਨ ਦਾ ਹਿੱਸਾ ਬਣਾਇਆ ਇਹਨਾਂ ਸੰਸਥਾਵਾਂ ਨੇ ਸਮਾਜਿਕ ਜਾਗਰੂਕਤਾ ਅਤੇ ਬਿਹਤਰ ਸਮੂਹਲਤਾ ਵਧਾਉਣ ਵਿੱਚ ਵੀ ਯੋਗਦਾਨ ਦਿੱਤਾ ਧਾਰਮਿਕ ਸਹਿਭਾਗ ਮਤਲਬ ਸਿੱਖ ਧਰਮ ਦੇ ਗੁਰੂਆਂ ਨੇ ਸਹਿਯੋਗ ਸੰਬੰਧਾਂ ਦੇ ਮਹੱਤਵ 'ਤੇ ਜੋਰ ਦਿੱਤਾ ਸਰਦਾਰ ਅਤੇ ਭਾਈ ਦੀ ਸੰਕਲਪਨਾ ਨੇ ਲੋਕਾਂ ਵਿੱਚ ਭਾਈਚਾਰਾ ਪੈਦਾ ਕੀਤਾ ਸ਼ਹਿਰ ਅਤੇ ਪਿੰਡਾਂ ਦੀਆਂ ਯਾਤਰਾਵਾਂ ਵਿੱਚ ਵੀ ਇਸ ਵਿੱਚ ਸ਼ਾਮਲ ਹਨ ਲੋਕਾਂ ਨੇ ਆਪਣੇ ਸਥਾਨ ਵਿੱਚ ਅਕਸਰ ਯਾਤਰਾਵਾਂ ਕਰਦੇ ਹਨ ਜਿਸ ਨਾਲ ਬੱਚੇ ਵੱਖ ਵੱਖ ਸੱਭਿਆਚਾਰ ਅਤੇ ਸ਼ੈਲੀਆਂ ਨੂੰ ਸਮਝਦੇ ਹਨ ਅਤੇ ਅੱਗੇ ਸਾਂਝਾ ਕਰਦੇ ਹਨ ਖੇਤੀਬਾੜੀ ਅਤੇ ਸਾਂਝੇ ਕੰਮ ਹੋਣ ਲੱਗ ਗਏ ਖੇਤਾਂ ਵਿੱਚ ਸਮੂਹਕ ਕੰਮ ਕਰਨ ਵਿੱਚ ਲੋਕਾਂ ਦੇ ਇਕੱਠੇ ਹੋ ਕੇ ਖੁਸ਼ੀਆਂ ਅਤੇ ਮੁਸ਼ਕਲਾਂ ਸਾਂਝਾ ਕੀਤੀਆਂ ਜਿਸ ਨਾਲ ਬਿਹਤਰ ਸੰਬੰਧ ਬਣੇ ਸਿੱਖਿਆ ਵਿਦਿਆਰਥੀਆਂ ਵਿੱਚ ਭਾਈਚਾਰਕਤਾ ਅਤੇ ਮੁਲਿਆਂ ਨੂੰ ਮਿਲਾਉਣ ਦੇ ਲਈ ਗੁਰਦੁਆਰਿਆਂ ਨੇ ਸਮਾਜਿਕ ਸੰਸਥਾ ਅਤੇ ਸਕੂਲਾਂ ਕੋਲਜਾਂ ਦੀ ਵੀ ਸਥਾਪਨਾ ਕੀਤੀ ਜਿਸ ਨਾਲ ਬਹੁਤ ਜ਼ਿਆਦਾ ਫਰਕ ਦੇਖਣ ਨੂੰ ਮਿਲਿਆ ਕਲਾ ਅਤੇ ਸੱਭਿਆਚਾਰ ਪੰਜਾਬੀ ਲਿਖਾਰੀ ਕਵੀ ਕਲਾਕਾਰਾਂ ਨੇ ਆਪਣੇ ਕੰਮਾਂ ਦੇ ਲਈ ਸੰਸਕਾਰਾਂ ਨੂੰ ਪ੍ਰਸਾਰਿਤ ਕੀਤਾ ਜਿਸ ਨਾਲ ਬੈਂਕ ਵਿੱਚ ਇੱਕ ਹੋਰ ਸਮਾਨਤਾ ਦਾ ਭਾਵ ਪੈਦਾ ਹੋਇਆ ਜੰਗਲ ਅਤੇ ਕੁਦਰਤ ਨੇ ਵੀ ਇਸ ਵਿੱਚ ਬਹੁਤ ਜ਼ਿਆਦਾ ਇਹ ਪ ਆਪਣਾ ਯੋਗਦਾਨ ਦਿੱਤਾ ਜਿਵੇਂ ਕਿ ਪੰਜਾਬ ਦੇ ਲੋਕ ਕੁਦਰਤੀ ਸਰੋਤਾਂ ਅਤੇ ਜੰਗਲਾਂ ਨੂੰ ਸਾਂਝਾ ਕਰ ਰਹੇ ਹਨ ਜੋ ਕਿ ਇੱਕ ਵੱਡਾ ਕੌਮੀ ਅਤੇ ਸਮਾਜਿਕ ਸਾਧਨ ਬਣੇ ਇਹਨਾਂ ਤਰੀਕਿਆਂ ਨੇ ਪੰਜਾਬ ਦੇ ਲੋਕਾਂ ਵਿੱਚ ਭਾਈਚਾਰਾ ਬਣਾਉਣ ਅਤੇ ਮਜਬੂਤ ਕਰਨ ਵਿੱਚ ਬਹੁਤ ਹੀ ਜ਼ਿਆਦਾ ਸਹਾਇਤਾ ਕੀਤੀ ਹੈ